ਪੰਦਰ੍ਹਾਂ ਅਗਸਤ ਦੋ ਹਜ਼ਾਰ ਪੰਦਰ੍ਹਾਂ ਅੱਠ ਅਕਤੂਬਰ ਦੋ ਹਜ਼ਾਰ ਸੱਤ ਬਾਰ੍ਹਾਂ ਅਪ੍ਰੈਲ ਦੋ ਹਜ਼ਾਰ ਬਾਰ੍ਹਾਂ ਇਕੱਤੀ ਜਨਵਰੀ ਉੱਨੀ ਸੌ ਪਚਾਸੀ ਤਿੰਨ ਜਨਵਰੀ ਉੱਨੀ ਸੌ ਬਹੱਤਰ